ਹੈਲੋ ਹੈਲੋ ਮੇਰੀ ਗੱਲ ਯੋਗਾ ਟੀਚਰ ਨਾਲ ਹੋ ਰਹੀ ਹੈ ਹਾਂਜੀ ਮੈਮ ਮੈਂ ਨਾ ਯੋਗਾ ਕਲਾਸ 'ਚ ਨਾ ਐਡਮਿਸ਼ਨ ਲੈਣਾ ਮੈਂ ਅਤੇ ਮੇਰੇ ਦੋ ਤਿੰਨ ਫਰੈਂਡ ਹੋਰ ਨੇ ਅਤੇ ਤੁਸੀਂ ਪਹਿਲਾਂ ਮੈਨੂੰ ਆਹ ਦੱਸੋ ਵੀ ਤੁਹਾਡੇ ਕੋਲ ਕਿਹੜੀ ਕਿਹੜੀ ਟਾਈਮਿੰਗ ਅਤੇ ਕਿਹੜੀ ਕਿਹੜੀ ਕਲਾਸ ਮਤਲਬ ਲੱਗ ਜੇਗੀ ਸਾਡੀ ਠੀਕ ਹੈ ਮੈਮ ਦੋ ਦੋ ਘੰਟੇ ਦੀ ਕਲਾਸ ਲਈ ਅੱਛਾ ਮੈਮ ਅਤੇ ਮਤਲਬ ਹੁਣ ਕਿਹੜੀ ਕਲਾਸ ਅਸੀਂ ਮਤਲਬ ਜੁਇਨ ਕਰੀਏ ਸਵੇਰ ਦੀ ਜਾਂ ਸ਼ਾਮ ਦੀ ਕਿਉਂਕਿ ਘਰੋਂ ਸਾਨੂੰ ਅੱਛਾ ਸ਼ਾਮ ਵਾਲੇ ਗਰੁੱਪ 'ਚ ਹੈਗੀ ਹੈ ਮਤਲਬ ਸਪੇਸ਼ ਅੱਛਾ ਮੈਮ ਅਸੀਂ ਤਿੰਨ ਜਾਂ ਚਾਰ ਮਤਲਬ ਆ ਜਾਵਾਂਗੇ ਤੁਹਾਡੇ ਕੋਲ ਹਾਂਜੀ ਹਾਂਜੀ ਮੈਮ ਨਹੀਂ ਮੈਮ ਸੁਬਹਾ ਦੀ ਨਹੀਂ ਫਿਰ ਉਹ ਫਿਰ ਸਕੂਲ ਵੀ ਜਾਣਾ ਹੁੰਦਾ ਹੈ ਨਾ ਤਾਂ ਕਰਕੇ ਫਿਰ ਸੁਬਹਾ ਦੀ ਸੈਟਿੰਗ ਤਾਂ ਨਾਲ ਹੁਣ ਸਰਦੀਆਂ ਵੀ ਹੋ ਗਈਆਂ ਅਤੇ ਇਸ ਲਈ ਥੋੜ੍ਹਾ ਆਉਣਾ ਮੁਸ਼ਕਿਲ ਹੋ ਗਿਆ ਹਾਂ ਸ਼ਾਮ ਨੂੰ ਉਹ ਸਾਡਾ ਸਹੀ ਰਹਿੰਦਾ ਅਤੇ ਅਸੀਂ ਦੇਖਦੇ ਹਾਂ ਕੱਲ੍ਹ ਸ਼ਾਮ ਬਸ ਮੈਮ ਲੋਕਲ ਹੈਗੇ ਹਾਂ ਹਾਂਜੀ ਹਾਂਜੀ ਮੈਮ ਅਤੇ ਤੁਸੀਂ ਉਹ ਫੀਸ ਵਗੈਰਾ ਦਾ ਉਹ ਵੀ ਸਾਨੂੰ ਦੱਸ ਦਿਓ ਅੱਛਾ ਮੈਮ ਅੱਛਾ ਮੈਮ ਫਿਰ ਤਾਂ ਅੱਛਾ ਮੈਮ ਠੀਕ ਹੈ ਮੈਮ ਆਹ ਮਤਲਬ ਡਿਸਕਾਊਂਟ ਹੈਗਾ ਅੱਛਾ ਮੈਮ ਹਾਂਜੀ ਮੈਮ ਅੱਛਾ ਮੈਮ ਠੀਕ ਹੈ ਮੈਮ ਅਤੇ ਫੈਸਿਲਿਟੀ ਵਗੈਰਾ ਕਲਾਸ ਵਿੱਚ ਹੀ ਕੁਝ

ਅੱਛਾ ਮੈਮ ਬਸ ਮੈਮ ਆਈ ਜਿਵੇਂ ਕਿ ਏਟੀਨ ਤੋਂ ਟਵੰਟੀ ਵਨ ਇੰਨੀ ਹੈਗੀ ਹੈ ਅਤੇ ਇਹਦੇ ਹੋਰ ਕੀ ਕੀ ਬੈਨੀਫਿਟ ਨੇ ਫਿਰ ਯੋਗਾਂ ਦੇ ਹਾਂਜੀ

ਅੱਛਾ ਮੈਮ ਠੀਕ ਠੀਕ ਹੈ ਮੈਮ ਅਤੇ ਮਤਲਬ ਜਿਵੇਂ ਯੈਲੋ ਔਰ ਬੇਕ ਪੇਨ ਹੈਗੀ ਹੈ ਅਤੇ ਉਹ ਕੁਝ ਠੀਕ ਹੋ ਹੋ ਜੇਗਾ ਅੱਛਾ ਮੈਮ ਅੱਛਾ ਮੈਮ ਠੀਕ ਠੀਕ ਹੈ ਮੈਮ ਅਤੇ ਫੀਸ ਉਹ ਆਨ ਆਨਲਾਈਨ ਜਾਂ ਆਫਲਾਈਨ ਕਰਨੀ ਹੈ ਅੱਛਾ ਮੈਮ ਫਿਰ ਜਦੋਂ ਅਸੀਂ ਆਵਾਂਗੇ ਉਦੋਂ ਹੀ ਤੁਹਾਨੂੰ ਦੇ ਦੇਵਾਂਗੇ ਫੀਸ ਹਾਂਜੀ ਠੀਕ ਹੈ ਮੈਮ ਥੈਂਕ ਯੂ ਮੈਮ